ਅੱਜ ਕੱਲ੍ਹ ਜਿਹੜੀ ਪ੍ਰਾਈਵੇਟ ਸਕੂਲ ਨੇ ਉਹਨਾਂ ਨੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਿੱਖਿਆ ਪ੍ਰਣਾਲੀ ਹੈ ਇੰਨੀ ਜ਼ਿਆਦਾ ਖਰਾਬ ਕਰ ਦਿੱਤੀ ਹੈ ਕਿ ਹਰ ਇੱਕ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਮਤਲਬ ਆਪਣੇ ਬੱਚੇ ਨੂੰ ਟਿਊਸ਼ਨ ਭੇਜਣਾ ਹੀ ਪੈਂਦਾ ਹੈ ਜੇ ਕੋਈ ਮਾਂ ਪਿਓ ਕੋਲ ਇੰਨਾ ਟਾਈਮ ਹੈ ਕਿ ਉਹ ਦੋ ਤੋਂ ਤਿੰਨ ਘੰਟੇ ਡੇਲੀ ਆਪਣੇ ਬੱਚੇ ਨੂੰ ਪੜ੍ਹਾ ਸਕੇ ਸਿਰਫ ਉਹੀ ਮਾਂ ਪਿਓ ਜਿਹੜਾ ਹੈ ਆਪਣੇ ਬੱਚੇ ਨੂੰ ਟਿਊਸ਼ਨ ਭੇਜਣ ਤੋਂ ਰੋਕ ਸਕਦਾ ਹੈ ਪਹੁੰਚਾ ਸਕਦਾ ਹੈ ਨਹੀਂ ਤਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਕੂਲ ਦੇ ਵਿੱਚ ਕਰਾ ਦਿੱਤਾ ਜਾਂਦਾ ਹੈ ਬਟ ਜਿਹੜੀ ਅਸਲੀ ਰਿਵੀਜ਼ਨ ਹੈ ਉਹ ਮਾਂ ਪਿਓ ਨੂੰ ਹੀ ਕਰਵਾਉਣੀ ਜ ਪੈਂਦੀ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਅੱਜ ਕੱਲ੍ਹ ਦੇ ਹੈਗੇ ਹੈ ਇਹ ਮਤਲਬ ਬਹੁਤ ਹੀ ਜ਼ਿਆਦਾ ਇਹ ਤੁਹਾਡੇ ਪੈਸੇ ਤੁਹਾਡੇ ਤੋਂ ਬਹੁਤ ਲੈਂਦੇ ਨੇ ਫੀਸਾਂ ਲੈ ਲੈਂਦੇ ਨੇ ਬਟ ਕਦੇ ਵੀ ਬੱਚੇ ਤੇ ਕੰਨਸਟਰੇਟ ਨਹੀਂ ਕਰਦੇ ਹੈਗੇ ਇਹ ਐਕਸਟਰਾ ਐਕਟੀਵਿਟੀ ਕਰਾਉਂਦੇ ਰਹਿ ਜਾਂਦੇ ਆ ਅਤੇ ਜਿਹੜੀ ਅਸਲੀ ਪੜ੍ਹਾਈ ਆ ਉਹ ਪੇਰੈਂਟਸ ਨੂੰ ਖੁਦ ਹੀ ਕਰਵਾਉਣੀ ਪੈਂਦੀ ਹੈ